ਰਚਨਾਤਮਕ ਲਿਖਣ ਦਾ ਕੋਈ ਕੋਰਸ ਤਾਂ ਨਹੀਂ ਲਿੱਤਾ ਹੈਗਾ ਬਟ ਹਾਂ ਇਹ ਹੈ ਕਿ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਾਂ ਨਿਊਜ਼ ਪੇਪਰ ਪੜ੍ਹਦੇ ਹੋ ਉਦੋਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਤੁਸੀ ਕੋਈ ਵੀ ਚੀਜ਼ ਜਦੋ ਲਿਖ ਕੇ ਉਹਨੂੰ ਆਪਣਾ ਪ੍ਰਜੈਂਟ ਕਰਨਾ ਤਾਂ ਉਹ ਕਿੱਦਾਂ ਪ੍ਰਜੈਂਟ ਕਰਨਾ ਮੇਰਾ ਤਰੀਕਾ ਤਾਂ ਇਹ ਹੀ ਰਹਿੰਦਾ ਹੈਗਾ ਕਿ ਹਾਂ ਜੋ ਚੀਜ਼ ਤੁਸੀਂ ਪੜ੍ਹ ਰਹੇ ਹੋ ਪੰਜਾਬੀ ਦੀ ਚਾਹੇ ਕੋਈ ਬੁੱਕ ਹੈ ਚਾਹੇ ਕੋਈ ਨਿਊਜ਼ ਪੇਪਰ ਹੈ ਉਹਦੇ ਵਿੱਚ ਦੇਖੋ ਕਿ ਹਾਂ ਇਹ ਚੀਜ਼ਾਂ ਕਿੱਦਾਂ ਲਿਖਦੇ ਨੇ ਉਹਨਾਂ ਦਾ ਕਿੱਦਾਂ ਸਨਟੈਂਸ ਮੇਕਿੰਗ ਹੁੰਦੀ ਹੈ ਤਾਂ ਉਹ ਚੀਜ਼ਾਂ ਪੜ੍ਹ ਪੜ੍ਹ ਕੇ ਇਸ ਤਰ੍ਹਾਂ ਹੀ ਆਦਤ ਪੈ ਚੁੱਕੀ ਹੈ ਕਿ ਹਾਂ ਉਸ ਨੂੰ ਪ੍ਰਜੈਂਟ ਕਿੱਦਾਂ ਕਰਨਾ ਹੈਗਾ ਅਤੇ ਬਾਕੀ ਤਾਂ ਇਹ ਹੀ ਆ ਕਿ ਜਿੰਨਾ ਪੜ੍ਹਾਂਗੇ ਉੰਨਾ ਪਤਾ ਚਲਦਾ ਰਹੇਗਾ ਦੈਟਸ ਇੱਟ